ਸਾਡੇ ਰਾਜ ਵਿੱਚ ਬੱਚਿਆਂ ਵਿੱਚ ਬਹੁਤ ਹੀ ਕਲਾ ਹਨ ਪਹਿਲੇ ਜ਼ਮਾਨੇ ਵਿੱਚ ਵੀ ਬੱਚਿਆਂ ਵਿੱਚ ਬਹੁਤ ਕਲਾ ਸੀ ਪਰ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਕਰਕੇ ਬੱਚੇ ਉੱਥੋਂ ਵੀ ਬਹੁਤ ਕੁਛ ਸਿੱਖਦੇ ਹਨ ਅਤੇ ਆਪਣੀ ਕਲਾ ਨੂੰ ਵਧਾਉਂਦੇ ਰਹਿੰਦੇ ਹਨ ਉਹ ਉੱਥੋਂ ਦੀ ਨਵੀਂ ਨਵੀਂ ਤਕਨੀਕਾਂ ਸਿੱਖਦੇ ਹਨ ਨਵੀਂ ਨਵੀਂ ਆਰਟ ਸਿੱਖਦੇ ਹਨ ਜਿਸ ਕਰਕੇ ਉਹ ਹੋਰ ਅੱਗੇ ਵਧਦੇ ਰਹਿੰਦੇ ਹਨ ਅਤੇ ਕੁਛ ਨਾ ਕੁਛ ਨਵੀਂ ਚੀਜ਼ ਸਿੱਖਦੇ ਰਹਿੰਦੇ ਹਨ ਨਵੀਂ ਨਵੀਂ ਚੀਜ਼ ਉਹ ਰੋਜ਼ ਦੇਖਦੇ ਹਨ ਅਤੇ ਸਿੱਖਦੇ ਹਨ ਇੱਦਾਂ ਹੀ ਉਹ ਆਪਣੀ ਕਲਾ ਨੂੰ ਵਧਾਉਂਦੇ ਰਹਿੰਦੇ ਹਨ ਉਹ ਆਪਣੀ ਕਲਾ ਦਾ ਵਿਕਾਸ ਕਰਦੇ ਰਹਿੰਦੇ ਹਨ ਇਹਨਾਂ ਵਿੱਚ ਬਹੁਤ ਹੀ ਫੋਰਮ ਵੀ ਆਪਣੀ ਰੁਚੀ ਦਿਖਾਉਂਦੇ ਹਨ ਉਹ ਬੱਚਿਆਂ ਨੂੰ ਨਵੀਆਂ ਨਵੀਆਂ ਚੀਜ਼ਾਂ ਸਿਖਾਉਂਦੇ ਹਨ ਅਤੇ ਬੱਚੇ ਉਸ ਨੂੰ ਸਿੱਖਦੇ ਹਨ ਅਤੇ ਉਸ ਨੂੰ ਹੋਰ ਵਧੀਆ ਤਰੀਕੇ ਨਾਲ ਨਿਭਾਉਂਦੇ ਹਨ ਇਹਨਾਂ ਵਿੱਚ ਫਾਰਮ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ ਉਹ ਸੋਸ਼ਲ ਮੀਡੀਆ ਵਿੱਚ ਇਸ ਦੀ ਫੋਟੋਜ਼ ਵੀਡੀਓਜ਼ ਪਾ ਦਿੰਦੇ ਹਨ ਅਤੇ ਬੱਚੇ ਉੱਥੋਂ ਦੇਖ ਦੇਖ ਕੇ ਸਿੱਖਦੇ ਹਨ ਅਤੇ ਆਪਣੀ ਕਲਾ ਨੂੰ ਵਧਾਉਂਦੇ ਰਹਿੰਦੇ ਹਨ ਧੰਨਵਾਦ